ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਔਨਲਾਈਨ ਵੀਡੀਓ ਕੌਨਫਰਸਿੰਗ ਐਪ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਨਾਲ ਸੰਬੰਧਿਤ ਜਾਂ ਵੈਸੇ ਕਿਸੇ ਦੇ ਨਾਲ ਮੀਟਿੰਗ ਕਰਨ ਦੇ ਲਈ ਵੱਖ ਵੱਖ ਤਰ੍ਹਾਂ ਦੀਆਂ ਐਪਸ ਉਪਲਬਧ ਹਨ ਜਿਹਦੇ ਵਿੱਚ ਮੁੱਖ ਤੌਰ 'ਤੇ ਆਪਾਂ ਜ਼ਿਕਰ ਕਰੀਏ ਤਾਂ ਗੂਗਲ ਮੀਟ ਅਤੇ ਜ਼ੂਮ ਐਪਸ ਮੁੱਖ ਹਨ ਅਤੇ ਕਰੋਨਾ ਕਾਲ ਵਿੱਚ ਇਹਨਾਂ ਐ ਇਹ ਐਪਸ ਨੇ ਪ੍ਰਮੁੱਖਤਾ ਦੇ ਨਾਲ ਆਪਣਾ ਯੋਗਦਾਨ ਦਿੱਤਾ ਕਿਉਂਕਿ ਉਸ ਟਾਈਮ ਲੌਕਡਾਊਨ ਦੀ ਸਥਿਤੀ ਦੇ ਵਿੱਚ ਸਾਰਾ ਕੁਛ ਬੰਦ ਸੀ ਤਾਂ ਇਸ ਕਰਕੇ ਇਹਨਾਂ ਐਪਸ ਨੇ ਖਾਸ ਕਰਕੇ ਅਗਰ ਆਪਾਂ ਗੂਗਲ ਐਪ ਦੀ ਗੱਲ ਕਰੀਏ ਤਾਂ ਵੱਖ ਵੱਖ ਕੋਲੇਜਾਂ ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਟੀਚਰਾਂ ਵਿੱਚ ਆਪਸ ਵਿੱਚ ਉਹਨਾਂ ਦਾ ਜੋ ਕਲਾਸ ਦਾ ਜੋ ਸਿਲੇਬਸ ਖਤਮ ਕਰਨ ਲਈ ਜੋ ਉਹਨਾਂ ਦਾ ਸੀਗਾ ਡੇਲੀ ਰੂਟੀਨ ਸੀ ਤਾਂ ਉਹ ਬਹੁਤ ਚੰਗੇ ਤਰੀਕੇ ਨਾਲ ਇਹਦੇ ਵਿੱਚ ਪੂਰੀ ਹੋਈ ਅਤੇ ਇਸ ਤੋਂ ਇਲਾਵਾ ਵ ਬਹੁਤ ਸਾਰੇ ਵਿਅਕਤੀ ਕੋ ਕੋਈ ਬਿਜਨਸ ਮੀਟਿੰਗ ਕੋਈ ਰਿਸਰਚ ਨਾਲ ਸੰਬੰਧਿਤ ਮੀਟਿੰਗ ਕਰਨ ਲਈ ਦੂਰ ਦੁਰਾਡੇ ਖੇਤਰਾਂ ਵਿੱਚ ਈਵਨ ਕਿ ਬਾਹਰ ਇਸ ਤੋਂ ਇਲਾਵਾ ਕਿ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਵਿਅਕਤੀਆਂ ਦੇ ਨਾਲ ਗੱਲਬਾਤ ਕਰਨੀ ਹੈ ਇਹ ਕਿਸੇ ਗਰੁੱਪ ਨੇ ਵੀ ਗੱਲਬਾਤ ਕਰਨੀ ਹੈ ਤਾਂ ਵੱਖ ਵੱਖ ਵਿਅਕਤੀ ਇੱਕ ਮੀਟਿੰਗ ਦੇ ਵਿੱਚ ਇਕੱਠੇ ਹੋ ਸਕਦੇ ਹਨ ਅਤੇ ਇਸ ਸੰਬੰਧੀ ਮੇਰਾ ਤਜ਼ਰਬਾ ਬਹੁਤ ਹੀ ਸ਼ਾਨਦਾਰ ਰਿਹਾ ਮੈਂ ਇਸ ਇਹ ਲਗਭਗ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰ ਆਪਣੇ ਜੋ ਮੇਰੇ ਸਾਥੀ ਹਨ ਜੋ ਕਿ ਯੂ ਐੱਸ ਏ ਦੇ ਵਿੱਚ ਬੈਠੇ ਹਨ ਜਾਂ ਹਾਂਗਕੌਂਗ ਦੇ ਵਿੱਚ ਬੈਠੇ ਹਨ ਉਹਨਾਂ ਨਾਲ ਗੂਗਲ ਮੀਟ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਹਾਂ ਇਸ ਸੰਬੰਧੀ ਨਾ ਪਸੰਦੀ ਦਾ ਮੇਨ ਮੁੱਖ ਕਾਰਨ ਇਹੀ ਹੈ ਕਿ ਕਈ ਵਾਰੀ ਇੰਟਰਨੈਟ ਦੀ ਕਨੈਕਟੀਵਿਟੀ ਐਨੀ ਚੰਗੀ ਨਹੀਂ ਰਹਿੰਦੀ ਨੈਟਵਰਕ ਡਾਊਨ ਹੋਣ ਕਰਕੇ ਤਾਂ ਗੂਗਲ ਮੀਟ ਵਗੈਰਾ ਬੰਦ ਹੋ ਜਾਂਦੀਆਂ ਹਨ ਬਾਕੀ ਹੋਰ ਇਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋਰ ਕੋਈ ਪ੍ਰੋਬਲਮ ਸਮੱਸਿਆ ਨਹੀਂ ਹੈ ਜੀ ਧੰਨਵਾਦ ਜੀ